ਵਿਕਾਸਸ਼ੀਲ ਸੰਸਾਰ ਹੈ ਜੋ ਇਸਦੇ ਵਿੱਚ ਜੋ ਸਰਕਾਰ ਵੱਲੋਂ ਲੋਕਾਂ ਲਈ ਜੋ ਵੀ ਕੀਤਾ ਜਾਂਦਾ ਹੈ ਉਸ ਨੂੰ ਹਰ ਥੋੜ੍ਹੇ ਚਿਰ ਬਾਅਦ ਉਸ ਨੂੰ ਦੁਬਾਰਾ ਰਿਵਾਈਜ਼ ਕੀਤਾ ਜਾਂਦਾ ਹੈ ਤਾਂ ਕਿ ਜੋ ਵੀ ਸਰਕਾਰ ਵੱਲੋਂ ਜੋ ਵੀ ਮਾਰਕਿਟ ਦੀਆਂ ਚੀਜ਼ਾਂ ਜਾਂ ਆਪਾਂ ਕਹਿ ਲਈਏ ਕਿ ਟੈਕਨਾਲੋਜੀ ਦੀਆਂ ਚੀਜ਼ਾਂ ਜੋ ਵੀ ਹੈ ਉਹਦੇ ਵਿੱਚ ਸੁਧਾਰ ਕੀਤਾ ਜਾਂਦਾ ਹੈ ਤਾਂ ਕਿ ਲੋਕਾਂ ਲਈ ਜਿਹੜਾ ਕੰਮ ਹੈ ਉਹ ਸੌਖਾ ਹੋ ਸਕੇ ਅਤੇ ਜਿਵੇਂ ਕਿ ਟੈਕਨਾਲੋਜੀ ਦੇ ਪੱਧਰ 'ਤੇ ਚੰਦਰਯਾਨ ਥ੍ਰੀ ਹੈ ਜਾਂ ਹੋਰ ਇੱਦਾਂ ਦੇ ਸਾਇੰਟੀ ਸਾਇੰਟਿਕ ਫਿਕ ਸਾਇੰਟੀਫਿਕ ਜੋ ਵੀ ਕੰਮ ਹਨ ਉਹਨਾਂ ਨੂੰ ਉੱਚਾ ਚੁੱਕਣਾ ਵਿਕਾਸਸ਼ੀਲ ਸੰਸਾਰ ਦੇ ਅੰਡਰ ਆਉਂਦਾ ਹੈ ਅਧੀਨ ਆਉਂਦਾ ਹੈ ਤੁਸੀਂ ਦੇਖਦੇ ਹੋ ਕਿ ਦੁਨੀਆਂ ਬਦਲ ਗਈ ਬਦਲ ਗਈ ਦੁਨੀਆਂ ਦੇ ਕੋਲ ਪਹਿਲਾਂ ਬਹੁਤ ਘੱਟ ਸਾਧਨ ਸਨ ਆਵਾਜਾਈ ਦੇ ਘੱਟ ਸਾਧਨ ਸਨ ਸੰਚਾਰ ਦੇ ਸਾਧਨ ਘੱਟ ਸਨ ਪਰੰਤੂ ਅੱਜ ਕੱਲ੍ਹ ਇਹ ਆਮ ਜਿਹੀ ਗੱਲ ਹੋ ਗਈ ਹੈ ਫੋਨ ਨੇ ਬੰਦਿਆਂ ਦੀ ਦੁਨੀਆਂ ਬਦਲ ਕੇ ਰੱਖ ਦਿੱਤੀ ਹੈ ਅਤੇ ਤੁਸੀਂ ਦੇਖਦੇ ਹੋ ਸੰਸਾਰ ਪੱਧਰ 'ਤੇ ਬਹੁਤ ਸਾਰੀਆਂ ਚੀਜ਼ਾਂ ਜੋ ਹਨ ਉਹਨਾਂ ਵਿੱਚ ਬਦਲਾਵ ਆਇਆ ਹੈ ਵਿਕਾਸਸ਼ੀਲ ਸੰਸਾਰ ਦਾ ਮਤਲਬ ਇਹ ਹੀ ਹੈ ਕਿ ਜਦੋਂ ਸਾਡੀਆਂ ਸਹੂਲਤਾਂ ਦੇ ਵਿੱਚ ਵਾਧਾ ਹੁੰਦਾ ਹੈ ਤਾਂ ਅਸੀਂ ਉਸਨੂੰ ਵਿਕਾਸਸ਼ੀਲ ਸੰਸਾਰ ਹੀ ਕਹਿ ਸਕਦੇ ਹਾਂ